ਮੈਂ ਜਸਪ੍ਰੀਤ ਬੋਲ ਰਹੀ ਹਾਂ ਹਾਂਜੀ ਮੈਮ ਮੈਂ ਬੁੱਕ ਸੋ ਸ਼ੋਪ ਤੋਂ ਬੋਲ ਰਹੀ ਹਾਂ ਹਾਂਜੀ ਦੱਸੋ ਤੁਹਾਨੂੰ ਕੀ ਚਾਹੀਦਾ ਸਾਡੀ ਬੁਕ ਸ਼ੋਪ ਤੋਂ ਅੱਛਾ ਤੁਹਾਨੂੰ ਠੀਕ ਹੈ ਤੁਹਾਨੂੰ ਮਿਲ ਜਾਣਗੇ ਦੀਆਂ ਇੰਗਲਿਸ਼ ਪੰਜਾਬੀ ਦੀ ਬੁੱਕ ਮਿਲ ਜਾਵੇਗੀ ਤੁਹਾਨੂੰ ਇੰਗਲਿਸ਼ ਦੀ ਬੁੱਕ ਮਿਲ ਜੂਗੀ ਹੋਰ ਵੀ ਜਿਹੜੀਆਂ ਨੇ ਉਸ ਸਬਜੈਕਟ ਨਾਲ ਰਿਲੇਟਡ ਬੁੱਕ ਮੈਂ ਤੁਹਾਨੂੰ ਸਾਰੀਆਂ ਬੁੁਕਸ ਸਾਡੀ ਸ਼ੋਪ ਤੋਂ ਮਿਲ ਜਾਣਗੀਆਂ ਹਾਂਜੀ ਇਹ ਬੁਕਸ ਤੁਹਾਨੂੰ ਘੱਟ ਤੋਂ ਘੱਟ ਵੀ ਪੰਦਰ੍ਹਾਂ ਸੌ ਤੱਕ ਬਣਨਗੀਆਂ ਇਹ ਡਿਸਕਾਊਂਟ ਅਸੀਂ ਤੁਹਾਨੂੰ ਪਹਿਲਾਂ ਹੀ ਫਿਫਟੀ ਪਰਸੈਂਟ ਦੇ ਦੇਵਾਂਗੇ ਉਸ ਤੋਂ ਬਾਅਦ ਤੁਹਾਨੂੰ ਕੋਈ ਡਿਸਕਾਊਂਟ ਨਹੀਂ ਮਿਲੇਗਾ ਅਤੇ ਇੰਨਾ ਰੇਟ ਤਾਂ ਲੱਗੇਗਾ ਹੀ ਅੱਛਾ ਉਹ ਕਿੰਨਾ ਡਿਸਕਾਊਂਟ ਦੇ ਰਹੇ ਸੀ ਨਹੀਂ ਸਰ ਇੰਨਾ ਡਿਸਕਾਊਂਟ ਅਸੀਂ ਤੁਹਾਨੂੰ ਕਿਵੇਂ ਦੇ ਸਕਦੇ ਹਾਂ ਪਰ ਅਸੀਂ ਤੁਹਾਡੀ ਇਹ ਹੈਲਪ ਕਰ ਸਕਦੇ ਹਾਂ ਸਾਡੇ ਕੋਲ ਪੁਰਾਣੀਆਂ ਬੁਕਸ ਹੈਗੀਆਂ ਨੇ ਜੇ ਤੁਸੀਂ ਉਹ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਉਹ ਮਿਲ ਸਕਦੀਆਂ ਨੇ ਹਾਫ ਰੇਟ 'ਤੇ ਮਿਲ ਸਕਦੀਆਂ ਨੇ ਵਧੀਆ ਬੁਕਸ ਇਸ ਨਵੇਂ ਸੈਸ਼ਨ ਦੀਆਂ ਜਿਹੜਾ ਦੋ ਹਜ਼ਾਰ ਚੌਵੀ ਛੱਬੀ ਸੈਸ਼ਨ ਹੈ ਇਹ ਤੁਸੀਂ ਵੇਖ ਲਓ ਤੁਸੀਂ ਕਿਹੜੀਆਂ ਬੁਕਸ ਲੈਣੀਆਂ ਨੇ ਸਾਡੇ ਕੋਲੋਂ ਹਾਂਜੀ ਸਾਰੀਆਂ ਬਿਲਕੁਲ ਵਧੀਆ ਬੁੱਕਸ ਨੇ ਫਰੈਸ਼ ਬੁਕਸ ਨੇ ਸਾਡੇ ਕੋਲ ਤੁਸੀਂ ਬੁਕ ਹਾਂਜੀ ਤੁਸੀਂ ਬੋਲੋ ਪਹਿਲਾਂ ਹਾਂਜੀ ਜ਼ਰੂਰ ਬਿਲਕੁਲ ਤੁਸੀਂ ਬਦਲ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਦਿੱਕਤ ਲੱਗਦੀ ਹੈ ਜੇ ਤੁਹਾਨੂੰ ਇਹ ਲੱਗਦਾ ਵਾ ਕਿ ਤੁਹਾਡੀ ਜਿਹੜੀ ਬੁਕ ਉਹ ਤੁਹਾਡੇ ਸਿਲੇਬਸ ਦੇ ਨਾਲ ਮੈਚ ਨਹੀਂ ਹੋ ਰਹੀ ਤਾਂ ਤੁਸੀਂ ਉਹ ਵੀ ਆਪਦਾ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਅਸੀਂ ਤੁਹਾਨੂੰ ਜਿਹੜੀ ਵੀ ਸਾਡੇ ਕੋਲ ਕਿਉਂਕਿ ਜਦੋਂ ਤੁਸੀਂ ਸਾਡੇ ਕੋਲ ਬੁੱਕ ਲੈਣੀ ਆ ਤਾਂ ਸਾਡਾ ਫਿਰ ਇਹਦੇ 'ਤੇ ਪੂਰਾ ਹੋਊਗਾ ਕਿ ਅਸੀਂ ਤੁਹਾਨੂੰ ਵਧੀਆ ਚੀਜ਼ ਦਈਏ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਗਰ ਤੁਸੀਂ ਮਾਰਕੀਟ ਵਿੱਚ ਕਿਸੇ ਹੋਰ ਦੁਕਾਨ 'ਤੇ ਨਾ ਜਾਓ ਸਾਡੇ ਕੋਲ ਆਉ ਸਾਡੇ ਕੋਲ ਤੁਹਾਨੂੰ ਸਾਰਾ ਮਾ ਜੋ ਵੀ ਤੁਹਾਨੂੰ ਬੁਕਸ ਚਾਹੀਦੀਆਂ ਨੇ ਕਿਉਂਕਿ ਇਹ ਤੋਂ ਬਾਅਦ ਹੋਰ ਵੀ ਤੁਹਾਨੂੰ ਕੋਈ ਵੀ ਬੁਕਸ ਚਾਹੀਦੀਆਂ ਸਾਡੇ ਕੋਲ ਸਭ ਕੁਝ ਅਬੇਲੈਬੇਲ ਹੈ ਹਾਂਜੀ ਭਾਅ ਜੀ ਤੁਹਾਨੂੰ ਅਸੀਂ ਹੱਲ ਕਰ ਦੇਵਾਂਗੇ ਜੇ ਕੋਈ ਵੀ ਦਿੱਕਤ ਹੋਊਗੀ ਅਸੀਂ ਤੁਹਾਨੂੰ ਤੁਸੀਂ ਚਲੋ ਨਵੀਂ ਬੁੱਕ ਵਾਸਤੇ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਕਰ ਦੇਵਾਂਗੇ ਜੇ ਤੁਹਾਨੂੰ ਤੁਹਾਨੂੰ ਲੱਗਦਾ ਕਿ ਤੁਹਾਡਾ ਸਲੈਬਸ ਨਹੀ ਮੈਚ ਹੋ ਰਿਹਾ ਤਾਂ ਤੁਸੀਂ ਸਾਡੇ ਨਾਲ ਸਾਨੂੰ ਦੱਸੋ ਅਸੀਂ ਤੁਹਾਨੂੰ ਨਵੀਂ ਬੁੱਕ ਦੇ ਵਿੱਚੋਂ ਵੀ ਥੋੜ੍ਹਾ ਬਹੁਤ ਹੋਰ ਡਿ ਹੋਰ ਡਿਸਕਾਊਂਟ ਦੇ ਦੇਵਾਂਗੇ ਪਰ ਉਂਝ ਸਾਰਿਆਂ ਵਾਸਤੇ ਥਰਟੀ ਪਰਸੈਂਟ ਹੁੰਦਾ ਪਰ ਤੁਸੀਂ ਚਾਹੁੰਦੇ ਹੋ ਕਿ ਕੁਛ ਬੁਕਸ ਲੈਣੀਆਂ ਤਾਂ ਜ਼ਰੂਰ ਅਸੀਂ ਦੇਵਾਂਗੇ ਹਾਂਜੀ ਜੇਕਰ ਤੁਸੀਂ ਬੁੱਕਸ ਮੰਗਵਾਉਣੀਆਂ ਨੇ ਤਾਂ ਤੁਹਾਡੇ ਕੋਲ ਅੱਜ ਗਿਆਰ੍ਹਾਂ ਤਰੀਕ ਹੈ ਤੁਹਾਡੇ ਕੋਲ ਪੰਦਰ੍ਹਾਂ ਨਵੰਬਰ ਤੱਕ ਬੁਕਸ ਪਹੁੰਚ ਜਾਣਗੀਆਂ ਤੁਹਾਡੇ ਘਰ ਅਤੇ ਉਹਦਾ ਅਸੀਂ ਕੋਈ ਵੀ ਚਾਰਜ ਨਹੀਂ ਲਵਾਂਗੇ ਜਿਹੜਾ ਤੁਸੀਂ ਬੁੱਕਸ ਦੇ ਨਾਲ ਸਾਨੂੰ ਬੁੱਕਸ ਦੇ ਪੈਸੇ ਦਿਉਗੇ ਬਸ ਅਸੀਂ ਉਹੀ ਪੈਸੇ ਲਵਾਂਗੇ ਤੁਹਾਨੂੰ ਹੋਰ ਕੋਈ ਐਕਸਟਰਾ ਚਾਰਜ ਵੀ ਨਹੀਂ ਲੱਗੇਗਾ ਕਿ ਤੁਹਾਡੇ ਘਰ ਬੁਕਸ ਆ ਰਹੀਆਂ ਬਸ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਨੂੰ ਕਿਹੜੀਆਂ ਬੁਕਸ ਚਾਹੀਦੀਆਂ ਨੇ ਅਤੇ ਕਿਹੜੇ ਆਥਰ ਦੀਆਂ ਬੁਕਸ ਚਾਹੀਦੀਆਂ ਨੇ ਕਿਉਂਕਿ ਸਾਡੇ ਕੋਲ ਵੱਖਰੇ ਵੱਖਰੇ ਲੇਖਕ ਹੁੰਦੇ ਆ ਤੁਹਾਨੂੰ ਪਤਾ ਹੀ ਆ ਬੁਕਸ ਦੇ ਅੱਛਾ ਹੋਰ ਤੁਹਾਨੂੰ ਕੋਈ ਹੋਰ ਬੁਕ ਇਸ ਤੋਂ ਇਲਾਵਾ ਤੁਹਾਨੂੰ ਹੋਰ ਕੀ ਚਾਹੀਦਾ ਕਿਉਂਕਿ ਜਿ ਜਿਹੜਾ ਆਪਣਾ ਫਸਟ ਈਅਰ ਆ ਉਹਦੇ ਵਿੱਚ ਤਾਂ ਤੁਹਾਨੂੰ ਸਾਰਾ ਮਤਲਬ ਸੈਟ ਹੀ ਚਾਹੀਦਾ ਉਸ ਹਿਸਾਬ ਨਾਲ ਓਕੇ ਠੀਕ ਹੈ ਸਾਡੇ ਕੋਲ ਸਾਰੀਆਂ ਨਵੇਂ ਸਿਲੇਬਸ ਦੀਆਂ ਬੁਕਸ ਨੇ ਜੇਕਰ ਤੁਹਾਨੂੰ ਕੋਈ ਪੁਰਾਣੀ ਬੁਕਸ ਚਾਹੀਦੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਉਹ ਨਵੇਂ ਸਿਲੇਬਸ ਦੀਆਂ ਬੁਕਸ ਨਵਾਂ ਹੀ ਆ ਫਰੈਸ਼ ਬੁਕਸ ਨੇ ਉਹ ਵੀ ਅਸੀਂ ਤੁਹਾਨੂੰ ਦੇ ਦੇਵਾਂਗੇ ਅਤੇ ਜੇ ਤੁਹਾਨੂੰ ਈ ਟੀ ਟੀ ਦੀ ਬੁੱਕਸ ਤੋਂ ਇਲਾਵਾ ਕੁਝ ਹੋਰ ਚਾਹੀਦਾ ਕੋਈ ਕਾਪੀਆਂ ਪੈੱਨ ਕੁਛ ਵੀ ਚਾਹੀਦਾ ਅਸੀਂ ਤੁਹਾਨੂੰ ਉਹ ਵੀ ਤੁਹਾਨੂੰ ਦੇ ਦੇਵਾਂਗੇ ਅਸੀਂ ਉਹ ਨਾਲ ਹੀ ਭੇਜ ਦੇਵਾਂਗੇ ਅਤੇ ਤੁਹਾਨੂੰ ਬਿਲਕੁਲ ਵੀ ਤੁਹਾਨੂੰ ਕੋਈ ਖਰਚਾ ਨਹੀਂ ਲੱਗੇਗਾ ਇਸ ਤੋਂ ਇਲਾਵਾ ਬੁਕਸ ਤੋਂ ਇਲਾਵਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਬਸ ਉਹੀ ਖਰਚਾ ਲੱਗੇਗਾ ਹੁਣ ਤੁਸੀਂ ਸਾਨੂੰ ਆਪਦੀ ਲਿਸਟ ਬਣਾ ਕੇ ਭੇਜ ਦਿਓ ਆਪਦਾ ਮੇਨ ਪਤਾ ਸਾਰਾ ਕੁਛ ਭੇਜ ਦਿਉ ਤਾਂ ਕਿ ਅਸੀਂ ਤੁਹਾਨੂੰ ਬੁੱਕਸ ਸੈਂਡ ਕਰ ਦਈਏ ਅਤੇ ਤੁਸੀਂ ਪਹਿਲਾਂ ਇਹ ਦੱਸੋ ਤੁਸੀਂ ਸਾਨੂੰ ਪੇਮੈਂਟ ਕਿਵੇਂ ਕਰੋਗੇ ਫਿਰ ਚਲੋ ਠੀਕ ਹੈ ਸਰ ਜਦੋਂ ਤੁਹਾਡੇ ਕੋਲ ਬੁੱਕਸ ਪਹੁੰਚ ਗਈਆਂ ਤਾਂ ਤੁਸੀਂ ਉਦੋਂ ਹੀ ਦੇ ਦਿਓ ਕੈਸ ਦੇ ਦਿਓ ਫੇਰ ਓਕੇ ਜੀ ਅਸੀਂ ਤੁਹਾਡਾ ਨਾਮ ਨੋਟ ਕਰ ਲਿਆ ਤੁਸੀਂ ਸਾਨੂੰ ਆਪਦਾ ਵਟਸਅਪ 'ਤੇ ਸਾਡੇ ਨੰਬਰ 'ਤੇ ਤੁਸੀਂ ਸਾਨੂੰ ਸੈਂਡ ਕਰ ਦਿਓ ਆਪਦੇ ਸਾਰੇ ਡਿਟੇਲ ਅਸੀਂ ਤੁਹਾਡਾ ਨਾਮ ਨੋਟ ਕਰ ਲਿਆ ਅਸੀਂ ਤੁਹਾਨੂੰ ਭੇਜ ਦੇਵਾਂਗੇ ਥੈਂਕ ਯੂ ਸੋ ਮੱਚ